ਹੈਲੋ ਸਤਿ ਸ਼੍ਰੀ ਅਕਾਲ ਭੈਣ ਜੀ ਵਧੀਆ ਤੁਸੀਂ ਯਾਦ ਹੀ ਨਹੀਂ ਕੀਤਾ ਕਦੇ ਮਿਲੇ ਵੀ ਨਹੀਂ ਪਾਰਕ 'ਚ ਵੀ ਨਹੀਂ ਆਏ ਕਦੇ ਹੁਣ ਕਿੱਥੇ ਰਹਿੰਦੇ ਜੇ ਅੱਛਾ ਜੀ ਚਲੋ ਜੀ ਵਧਾਈ ਹੋਵੇ ਅੱਛਾ ਜੀ ਇਹ ਤਾਂ ਚਲੋ ਬੱਚਿਆਂ ਦੇ ਚਲੋ ਅੱਗੋਂ ਕਹੀ ਦਾ ਤਰੱਕੀ ਵਾਸਤੇ ਅਤੇ ਵਧੀਆ ਗੱਲਾਂ ਪਰ ਪੰਜਾਬ ਵਿਹਲਾ ਹੁੰਦਾ ਜਾ ਰਿਹਾ ਜੇ ਅੱਛਾ ਜੀ ਹਾਂਜੀ ਹਾਂਜੀ ਹਾਂਜੀ

ਅੱਛਾ ਜੀ ਆਪਦੇ ਆਪਣਾ ਰੋਟੀ ਪਾਣੀ ਵੀ ਕਰਨਾ ਕੰਮ ਹ ਹੈ ਨਾ ਕੰਮ ਵੀ ਕਰਨਾ ਅਤੇ ਪੜ੍ਹਾਈ ਵੀ ਕਰਨੀ ਬੜਾ ਔਖਾ ਵਾ ਸਾਨੂੰ ਤਾਂ ਡਾਲਰ ਹੀ ਦਿਖਦੇ ਇੱਥੇ ਬੈਠਿਆਂ ਨੂੰ ਹੈ ਨਾ ਆ ਅਤੇ ਟਾਈਮ ਨਹੀਂ ਹਾਂਜੀ ਹਾਂ ਅਤੇ ਮੈਂ ਤਾਂ ਸੋਚਦੀ ਪੈਸਿਆਂ ਦਾ ਕਰਕੇ ਕਹੀਦਾ ਪੈਸਿਆਂ ਕਰਕੇ ਹੀ ਜਾਂਦੇ ਬੱਚੇ ਓਹ ਤਰ੍ਹਾਂ ਕਿਹਦਾ ਜੀਅ ਕਰਦਾ ਜੇ ਘਰ ਛੱਡਣ ਨੂੰ ਹੈ ਨਾ ਪੈਸਿਆਂ ਕਰਕੇ ਪੰਜਾਬ 'ਚ ਨੌਕਰੀਆਂ ਹੈ ਨੀ ਨਾ ਇੰਨੀਆਂ ਖਾਸ ਕੋਈ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਫਿਊਚਰ ਦਾ ਕਰਕੇ ਹੀ ਬਸ ਪਾ ਰਹੇ ਆ ਵੀ ਚਲੋ ਬੱਚੇ ਤਰੱਕੀ ਕਰਨ ਤਾਂ ਪੇਰੈਂਟਸ ਨੂੰ ਖੁਸ਼ੀ ਹੁੰਦੀ ਹੈ ਬਾਕੀ ਇਹ ਕੀ ਇੱਥੋਂ ਤੁਹਾਡੇ ਸਾਹਿਬ ਨਾਲ ਬਾਹਰ ਜਾਣ ਲਈ ਪੜ੍ਹ ਲਿਖ ਕੇ ਜਾਣਾ ਚਾਹੀਦਾ ਜਾਂ ਕੰਮਕਾਰ ਕੋਈ ਸਿੱਖ ਕੇ ਜਾਣਾ ਚਾਹੀਦਾ ਤੁਹਾਡੇ ਹਿਸਾਬ ਨਾਲ ਜੇ ਅਸੀਂ ਅਸ਼ਮੀਤ ਦਾ ਵੀ ਕਰਨਾ ਹੋਵੇ ਅਤੇ ਕਿਸ ਤਰ੍ਹਾਂ ਕਰਨਾ ਚਾਹੀਦਾ ਜੇ ਅੱਛਾ ਜੀ ਉਹ ਕਈ ਵਾਰੀ ਤਾਂ ਕਹਿੰਦੇ ਨਾ ਕਈ ਕਹਿੰਦੇ ਪਲੱਸ ਟੂ ਕਰਕੇ ਸੌਖਾ ਮਿਲ ਜਾਂਦਾ ਉਹ ਕੀ ਵੀਜ਼ਾ ਹਾਂਜੀ ਹਾਂਜੀ ਹਾਂਜੀ ਹਾਂਜੀ ਆਹੋ ਫਿਰ ਉੱਥੇ ਓਹ ਪੀਜ਼ੇ ਪੂਜ਼ੇ ਜੇ ਹੀ ਵੇਚਦੇ ਬੱਚੇ ਬਣਾਉਂਦੇ ਹਾਂਜੀ ਹਾਂਜੀ ਹਾਂਜੀ ਅੱਛਾ ਤੁਹਾਡੇ ਹਿਸਾਬ ਨਾਲ ਇਹ ਵੀ ਇੱਥੋਂ ਚੰਗੀ ਤਰ੍ਹਾਂ ਪੜ੍ਹਾ ਕੇ ਅਤੇ ਫਿਰ ਭਾਵੇਂ ਜੇ ਮਿਲੇ ਅਤੇ ਹੈ ਨਾ ਹਾਂਜੀ ਹਾਂਜੀ ਓ ਪੈਸੇ ਕਿੰਨੇ ਕੁ ਲੱਗ ਜਾਂਦੇ ਜੇ ਬਾਹਰ ਦੇ ਪੱਚੀ ਅਠਾਈ ਲੱਖ ਮੇਰਾ ਖਿਆਲ ਲੱਗ ਜਾਂਦਾ ਹਾਂ ਓ ਹੋ ਹੋ ਹਾਂ ਇਹ ਵੀ ਬੜਾ ਔਖਾ ਵਾ ਵੀ ਅੱਗੋਂ ਪੂਰੇ ਪਤਾ ਨਹੀਂ ਕਿੱਦਣ ਹੋਣੇ ਆ ਪਹਿਲਾਂ ਤਾਂ ਓਹੀ ਪੂਰੇ ਹੋਣੇ ਜਿਹੜੇ ਜਾਣੇ ਆ ਨਾ ਪੱਲਿਓਂ ਲੱਗਣੇ ਜਿਹੜੇ ਉਹੀ ਪੂਰੇ ਹੋਣੇ ਆ ਅਤੇ ਫਿਰ ਕਿਤੇ ਮਿਹਨਤਾਂ ਕਰ ਕਰ ਕੇ ਸਖਤ ਮਿਹਨਤ ਆ ਬਾਹਰ ਤਾਂ ਬਰਫਾਂ ਦੇ ਵਿੱਚ ਹੈ ਨਾ ਠੰਡ 'ਚ ਕੰਮ ਕਰਨਾ ਹਾਂ ਠੀਕ ਹੈ ਜੀ ਠੀਕ ਓ ਹਾਂਜੀ ਹਾਂਜੀ ਓਕੇ ਜੀ